ਬਾਗ਼ਬਾਨੀ ਵਿੱਚ ਇਸ ਦੀ ਵਰਤੋਂ ਜਿਹੜੀ ਹੈਗੀ ਹੈ ਬੜੇ ਸਹੀ ਢੰਗ ਨਾਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਆਪਾਂ ਕੋਈ ਵੀ ਫ਼ਰੂਟ ਹੈ ਆਪਣਾ ਹੈ ਨਾ ਜਿਵੇਂ ਹੁਣ ਫ਼ਰੂਟ ਨੂੰ ਬਚਾਉਣ ਵਾਸਤੇ ਉਹਨੂੰ ਆਪਾਂ ਕਵਰ ਕਰਕੇ ਰੱਖ ਸਕਦੇ ਹਾਂ ਜਿਹੜਾ ਲੰਬੇ ਸਮੇਂ ਤੱਕ ਉਹਦੀ ਵਰਤੋਂ ਕੀਤੀ ਜਾ ਸਕੇ ਜਿਸ ਤਰ੍ਹਾਂ ਹੁਣ ਕਈ ਜਗ੍ਹਾ 'ਤੇ ਜਿਵੇਂ ਹੁਣ ਆਪਾਂ ਕੋਈ ਚੀਜ਼ ਬੀਜਦੇ ਨੇ ਬੀਜਣ ਲੱਗੇ ਜਿਵੇਂ ਹੁਣ ਸਰਦੀਆਂ ਦੇ ਟਾਈਮ ਦੇ ਵਿੱਚ ਕੋਹਰਾ ਬਹੁਤ ਪੈਂਦਾ ਉਹ ਕੋਹਰੇ ਤੋਂ ਬਚਾਉਣ ਲਈ ਜਿਹੜਾ ਹੈਗਾ ਇਹਦਾ ਇਹਦੀ ਵਛਾਉਣ ਕਾਰਨ ਕਾਫੀ ਬਚਾਉ ਕੀਤਾ ਜਾ ਸਕਦਾ ਹੈ ਕਾਫੀ ਸਹੀ ਵਰਤੋਂ ਕੀਤੀ ਜਾ ਸਕਦੀ ਹੈ ਬਹੁਤ ਫ਼ਾਇਦੇਮੰਦ ਹੁੰਦੀਆਂ ਨੇ ਇਹ ਚੀਜ਼ਾਂ ਅਤੇ ਸਾਨੂੰ ਹਮੇਸ਼ਾ ਇਹ ਵਰਤਣ ਵਿੱਚ ਲਿਆਵਾਂਗੇ ਤਾਂ ਜ਼ਿਆਦਾ ਚੰਗਾ ਰਹੇਗਾ